ਕੋਵਿਡ ਲੌਕਡਾਉਨ ਦੌਰਾਨ ਮੋਬਾਈਲ ਫੋਨ ਨੇ ਬੱਚਿਆਂ ਦੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਜਿਵੇਂ ਕਿ ਦੇਖਿਆ ਜਾਵੇ ਫਾਇਦੇ ਵਿੱਚ ਬੱਚਿਆਂ ਨੂੰ ਸਕੂਲ ਜਾਣ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਬੱਚੇ ਘਰ ਬੈਠ ਕੇ ਹੀ ਆਸਾਨੀ ਔਨਲਾਈਨ ਕਲਾਸਾਂ ਲਗਾਉਂਦੇ ਸਨ ਘਰ ਵਿੱਚ ਕੋਈ ਰੌਲਾ ਰੱਪਾ ਨ ਵੀ ਨਹੀਂ ਹੁੰਦਾ ਅਤੇ ਬੱਚਿਆਂ ਦਾ ਸਕੂਲ ਆਉਣ ਜਾਣ ਦਾ ਟਾਈਮ ਵੀ ਬਚਦਾ ਸੀ ਨੁਕਸਾਨ ਵਿੱਚ ਦੇਖਿਆ ਜਾਵੇ ਕਿ ਬੱਚਿਆਂ ਨੂੰ ਨੈੱਟਵਰਕ ਦੀ ਪ੍ਰੋਬ ਪ੍ਰੋਬਲਮ ਬਹੁਤ ਆਉਂਦੀ ਸੀ ਜਿਸ ਕਾਰਨ ਅਧਿਆਪਕ ਦਾ ਪੜ੍ਹਾਇਆ ਸਮਝ ਨਹੀਂ ਆਉਂਦਾ ਸੀ ਅਤੇ ਬੱਚੇ ਨਕਲ ਮਾਰ ਕੇ ਪੇਪਰ ਦਿੰਦੇ ਸੀ ਜਿਸ ਕਾਰਨ ਬੱਚਿਆਂ ਦਾ ਭਵਿੱਖ ਖਰਾਬ ਹੁੰਦਾ ਸੀ